ਮੇਰਾ ਨਾਮ ਮੋਨਿਕਾ ਹੈ ਅੱਜ ਮੈਂ ਤੁਹਾਨੂੰ ਸਾਡੇ ਪਿੰਡ ਵਿੱਚ ਖੇਡ ਸ ਸਿਖਲਾਈ ਕੇਂਦਰ ਬਾਰੇ ਦੱਸਣਾ ਚਾਹੁੰਦੀ ਹੈ ਉਸ ਬਾਰੇ ਬਹੁਤ ਕੁਝ ਗੱਲਾਂ ਹਨ ਉਸ ਕੇਂਦਰ ਦਾ ਨਾਮ ਸੇਵਾ ਕੇਂਦਰ ਹੈ ਇਸ ਕੇਂਦਰ ਵੀ ਨੂੰ ਅਲੱਗ ਅਲੱਗ ਪ੍ਰੋਗਰਾਮ ਵਿੱਚ ਲਗਾਇਆ ਜਾਂਦਾ ਹੈ ਜਿਵੇਂ ਕਿ ਉਸ ਬਾਰੇ ਸਾਨੂੰ ਅਲੱਗ ਅਲੱਗ ਪ੍ਰਕਾਰ ਦੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ ਕਬੱਡੀ ਜੋ ਬੰਦਾ ਕਬੱਡੀ ਖੇਡਦਾ ਹੈ ਉਸਨੂੰ ਕਬੱਡੀ ਬਾਰੇ ਦੱਸਿਆ ਜਾਂਦਾ ਹੈ ਅਤੇ ਜੋ ਖੇਤ ਵਿੱਚ ਕੰਮ ਮਜ਼ਦੂਰ ਕਰਦੇ ਹਨ ਉਸ ਨੂੰ ਖੇਤੀਬਾੜੀ ਬਾਰੇ ਦੱਸਿਆ ਜਾਂਦਾ ਹੈ ਸਾਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਸਿਖਲਾਈ ਦਿੱਤੀ ਜਾਂਦੀ ਹੈ ਸਿੱਖਿਆ ਦਿੰਦੇ ਹਨ ਅਤੇ ਕਸਰਤ ਕਰਨ ਵਾਲੇ ਨੂੰ ਕਸਰਤ ਬਾਰੇ ਦੱਸਿਆ ਜਾਂਦਾ ਹੈ ਉੱਥੇ ਹਰ ਇਕ ਹਰ ਰੋਜ਼ ਅਲੱਗ ਅਲੱਗ ਕੋਚ ਸਰ ਆਉਂਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਜੋ ਚੀਜ਼ਾਂ ਨਹੀਂ ਪਤਾ ਉਹ ਪਿਆਰ ਨਾਲ ਸਮਝਾਉਂਦੇ ਹਨ ਅਤੇ ਸਾਨੂੰ ਬਦਲ ਬਦਲ ਕੇ ਹਰੇਕ ਚੀਜ਼ਾਂ ਬਾਰੇ ਦੱਸਿਆ ਵੀ ਜਾਂਦਾ ਹੈ ਇਹ ਇਹ ਕੰਮ ਸਾਨੂੰ ਫ੍ਰੀ ਵਿੱਚ ਹੀ ਸਿਖਾਇਆ ਜਾਂਦਾ ਹੈ ਇਸ ਵਿੱਚ ਕੋਈ ਵੀ ਫੀਸ ਨਹੀਂ ਲਿੱਤੀ ਜਾਂਦੀ ਅਤੇ ਸਾਰਿਆਂ ਨੂੰ ਇਹ ਕੰਮ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਉਹ ਸਾਰੇ ਇਸ ਕੰਮ ਨੂੰ ਕਰਕੇ ਵੀ ਦੇਖਦੇ ਹਨ ਅਤੇ ਉਹ ਸਾਰੇ ਖੁਸ਼ ਵੀ ਹੋ ਜਾਂਦੇ ਜਿਵੇਂ ਕਿ ਖੇਤੀਬਾੜੀ ਵਾਲਿਆਂ ਨੂੰ ਖੇਤੀ 'ਚ ਕਈ ਵੇਲੇ ਫਸਲ ਨਹੀਂ ਉੱਗਦੀ ਸੀ ਉਹ ਹੁਣ ਫਸਲ ਵੀ ਉੱਗਣ ਲੱਗ ਜਾਂਦੀ ਹਨ ਅਤੇ ਅਲੱਗ ਅਲੱਗ ਪ੍ਰਕਾਰ ਦੇ ਬੱਚਿਆਂ ਨੂੰ ਵੀ ਇੱਥੇ ਸਿੱਖਿਆ ਦਿੱਤੀ ਜਾਂਦੀ ਹੈ ਉਹਨਾਂ ਨੂੰ ਜੋ ਵੀ ਕੰਮ ਕਰਨਾ ਹੈ ਸਾਰਿਆਂ ਨਾਲੋਂ ਵਧੀਆ ਅਤੇ ਧਿਆਨ ਨਾਲ ਸਿਖਾਉਂਦੇ ਸਨ